ਮੈਂ ਬਹੁਤ ਸਾਰੇ ਸਕੈੱਚ ਬਣਾਉਂਦੀ ਹਾਂ ਅਤੇ ਜਦੋਂ ਸਕੈੱਚ ਬਣਾਉਂਦੀ ਹਾਂ ਤਾਂ ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੈਸੇ ਤਾਂ ਹਰ ਇੱਕ ਹੀ ਕਲਾਕਾਰ ਨੂੰ ਕੋਈ ਨਾ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਇਹ ਇੱਕ ਇਹੋ ਜਿਹਾ ਕੰਮ ਹੈ ਜਿਸ ਕ ਵਿੱਚ ਕਿ ਪੂਰੀ ਇਕਾਗਰਤਾ ਚਾਹੀਦੀ ਹੈ ਤਾਂ ਕਿ ਕੋਈ ਡਿਸਟਰਬ ਨਾ ਕਰੇ ਪਰ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਆਪਾਂ ਸਕੈੱਚ ਬਣਾਉਣ ਲੱਗਦੇ ਹਾਂ ਤਾਂ ਕੋਈ ਨਾ ਕੋਈ ਕੰਮ ਆਪਾਂ ਨੂੰ ਵੀ ਪੈ ਜਾਂਦਾ ਹੈ ਅਤੇ ਕਈ ਵਾਰ ਆਪਣੇ ਪਰਿਵਾਰਕ ਮੈਂਬਰ ਅਤੇ ਕੋਈ ਹੋਰ ਆ ਕੇ ਸਾਨੂੰ ਡਿਸਟਰਬ ਕਰ ਦਿੰਦਾ ਹੈ ਕੋਈ ਕੰਮ ਕਰਨ ਲਈ ਬੋਲ ਦਿੰਦਾ ਹੈ ਅਤੇ ਸਾਨੂੰ ਉੱਠ ਕੇ ਉਹ ਕੰਮ ਕਰਨਾ ਪੈਂਦਾ ਹੈ ਅਤੇ ਫਿਰ ਆਪਣਾ ਧਿਆਨ ਭਟਕ ਜਾਂਦਾ ਹੈ ਅਤੇ ਉਹ ਚੀਜ਼ ਸਹੀ ਨਹੀਂ ਬਣ ਪਾਉਂਦੀ ਅਤੇ ਕਈ ਵਾਰ ਇਹ ਹੁੰਦਾ ਹੈ ਕਿ ਸਕੈੱਚ ਬਾਹਰ ਖੜ੍ਹ ਕੇ ਬਣਾਉਣਾ ਪੈਂਦਾ ਹੈ ਲਾਈਟ ਦੀ ਵਜ੍ਹਾ ਕਰਕੇ ਫਿਰ ਕਈ ਵਾਰ ਧੁੱਪ ਆ ਜਾਂਦੀ ਹੈ ਛਾਵੇਂ ਹੋਣਾ ਪੈਂਦਾ ਹੈ ਇਸ ਵਜ੍ਹਾ ਕਰਕੇ ਵੀ ਕਈ ਵਾਰ ਧਿਆਨ ਭੰਗ ਹੋ ਜਾਂਦਾ ਹੈ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਜਦੋਂ ਸਕੈੱਚ ਬਣਾਉਂਦੇ ਹਾਂ ਪਰ ਇਹ ਇੱਕ ਇਹੋ ਜਿਹਾ ਕੰਮ ਹੈ ਜਿਸ ਵਿੱਚ ਕਿ ਪੂਰੀ ਇਕਾਗਰਤਾ ਚਾਹੀਦੀ ਹੈ ਇਹ ਇਸ ਕੰਮ ਵਿੱਚ ਜਦੋਂ ਆਪਾਂ ਇੱਕ ਵਾਰ ਲੱਗ ਜਾਂਦੇ ਹਾਂ ਅਤੇ ਫਿਰ ਖ਼ਤਮ ਕਰਕੇ ਹੀ ਉੱਠੀਏ ਤਾਂ ਇਸ ਚੀਜ਼ 'ਚ ਵਧੀਆ ਸਕੈੱਚ ਬਣਦਾ ਹੈ ਅਤੇ ਆਪਣਾ ਧਿਆਨ ਵਧੀਆ ਤਰੀਕੇ ਨਾਲ਼ ਲੱਗਦਾ ਹੈ